ਮੈਂ ਸੰਸਾਧਨ ਕਲਾ ਬਾਰੇ ਜੋ ਬਰੈਟੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਣਦੀ ਹੈ ਉਸ ਬਾਰੇ ਦੱਸਣਾ ਚਾਹੁੰਦਾ ਹਾਂ ਪਾਪੜ ਵੜੀਆਂ ਸੂਟ ਸ਼ਿਲਪਕਾਰੀ ਦੇ ਵਿੱਚ ਜਿਹੜੇ ਆਉਂਦੇ ਹਨ ਆਲੂ ਵਾਲਾ ਕੁਲਚਾ ਸਾਦਾ ਕੁਲਚਾ ਪੰਜਾਬੀ ਜੁੱਤੀ ਇਹ ਜਿਹੜੀਆਂ ਚੀਜ਼ਾਂ ਦੇਸ਼ ਵਿਦੇਸ਼ ਵਿੱਚ ਬਾਹਰੋਂ ਜਿਹੜੇ ਆਉਂਦੇ ਨੇ ਉਹ ਲੈ ਕੇ ਜਾਂਦੇ ਹਨ ਅਤੇ ਅੰਮ੍ਰਿਤਸਰੀ ਕੁਲਚਾ ਜਿਹੜਾ ਇੱਥੇ ਆਣ ਕੇ ਸਵਾਦ ਨਾਲ ਖਾਂਦਾ ਹੈ ਆਲੂਆਂ ਦਾ ਕੁਲਚਾ ਚਾਹੇ ਸਾਦਾ ਕੁਲਚਾ ਉਹ ਪੈਕ ਕਰਵਾ ਕੇ ਬਾਹਰ ਵੀ ਲੈ ਕੇ ਜਾਂਦਾ ਹੈ ਜਿਹੜੇ ਦੂਜੇ ਸਮਾਨ ਨੇ ਪਾਪੜ ਵੜੀਆਂ ਇਹ ਦੂਰ ਬੜੇ ਬੜੇ ਬੁ ਮੁਲਕਾਂ ਦੇ ਵਿੱਚ ਮਾਲ ਬਾਹਰ ਲੈ ਕੇ ਜਾਂਦੇ ਹਨ ਇਹ ਜਿਹੜੇ ਕਾਰੋਬਾਰ ਕਰਨ ਵਾਲੇ ਪੀੜ੍ਹੀਆਂ ਦਰ ਪੀੜ੍ਹੀਆਂ ਕਰਦੇ ਆ ਰਹੇ ਹਨ ਜਿਨ੍ਹਾਂ ਦੀ ਵਿਲੱਖਣ ਹੈ ਜੋ ਇਹ ਸਮਾਨ ਬਣਾਉਂਦੇ ਹਨ ਬਹੁਤ ਹੀ ਖਾਣ ਦੇ ਕਾਬਲ ਜਾਂ ਪਹਿਨਣ ਦੇ ਕਾਬਲ ਵਾਲੇ ਜਿਹੜੇ ਹੈਗੇ ਨੇ ਉਹ ਬਹੁਤ ਹੀ ਸੁੰਦਰ ਹਨ ਅਤੇ ਉਹਨਾਂ ਨਾਲ ਉਹ ਪੀੜ੍ਹੀ ਦਰ ਪੀੜ੍ਹੀ ਜਿਹੜੇ ਕਰ ਰਹੇ ਨੇ ਉਹਨਾਂ ਦਾ ਵੀ ਮਨ ਖੁਸ਼ ਹੁੰਦਾ ਵੀ ਚੰਗੇ ਤੋਂ ਚੰਗਾ ਸਮਾਨ ਬਣਾਈਏ ਅਤੇ ਬਾਹਰ ਦੇ ਮੁਲਕਾਂ ਤੱਕ ਜਾਵੇ